ਹੈਲੋ ਸਤਿ ਸ਼੍ਰੀ ਅਕਾਲ ਜੀ ਅਤੇ ਕੌਣ ਮਨਦੀਪ ਸਿੰਘ ਬੋਲ ਰਹੇ ਹੋ ਜੀ ਹਾਂਜੀ ਸਰ ਮੈਂ ਮੈਡੀਸਨ ਲੈ ਕੇ ਗਿਆ ਸੀ ਤੁਹਾਡੇ ਤੋਂ ਸਰ ਮੈਂ ਰਾਮ ਲਾਲ ਬੋਲ ਰਿਹਾ ਰਾਮ ਲਾਲ ਬੋਲ ਰਿਹਾ ਜੀ ਮੈਂ ਮੈਡੀਸਨ ਕਰੀਬ ਡੇਢ ਕੁ ਹਫ਼ਤੇ ਪਹਿਲਾਂ ਲੈ ਗਿਆ ਸੀਗਾ ਜੀ ਮੇਰੀ ਮੈਡੀਸਨ ਚੱਲਦੀ ਆ ਡਾਕਟਰ ਰਵਿੰਦਰ ਸਿੰਘ ਤੋਂ ਤਾਂ ਸਰ ਬੇਨਤੀ ਆ ਕਿ ਮੈਨੂੰ ਇਹ ਦੱਸੋ ਕਿ ਮੈਡੀਸਨ ਕਿਵੇਂ ਕਿਵੇਂ ਕਿਸ ਤਰ੍ਹਾਂ ਖਾਣੀ ਹੈ ਮੈਡੀਸਨ ਮੈਡੀਸਨ ਜੋ ਹੈ ਜੀ

ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਸਰ ਠੀਕ ਹੈ ਸਰ ਅਤੇ ਅਤੇ ਸਰ

ਜੀ ਸਰ ਹਾਂਜੀ ਹਾਂਜੀ ਸਰ ਅਤੇ ਇੱਕ ਸਰ ਇਹ ਪੁੱਛਣਾ ਸੀ ਕਿ ਮੈਡੀਸਨ ਜਿਹੜੀ ਮੈਂ ਸਵੇਰੇ ਮੋਰਨਿੰਗ ਟਾਈਮ ਇੱਕ ਹੀ ਲੈਣੀ ਹੈਗੀ ਅਤੇ ਈਵਨਿੰਗ 'ਚ ਈਵਨਿੰਗ 'ਚ ਨਾਈਟ 'ਚ ਇੱਕ ਸਵੇਰੇ ਲੈਣੀ ਆ ਸਰ ਹਾਂਜੀ ਸਰ ਹਾਂਜੀ ਖ਼ਾਲੀ ਪੇਟ ਖਾਣੇ ਤੋਂ ਇੱਕ ਘੰਟਾ ਪਹਿਲਾਂ ਠੀਕ ਹੈ ਜੀ ਚਾਹ ਤੋਂ ਇਕ ਘੰਟਾ ਬਾਅਦ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਦੋਨਾਂ ਦੇ ਵਿੱਚ ਇੱਕ ਇੱਕ ਘੰਟੇ ਦਾ ਫ਼ਰਕ ਰੱਖਾਂ ਇਕ ਘੰਟੇ ਦਾ ਠੀਕ ਆ ਸਰ ਅਤੇ ਹੋਰ ਇਸ ਤੋਂ ਇਲਾਵਾ ਨਾਈਟ 'ਚ ਤਾਂ ਕੋਈ ਨਹੀਂ ਲੈਣੀ ਸਰ ਅੱਛਾ ਸਵੇਰੇ ਮੋਰਨਿੰਗ ਟਾਈਮ ਜਿਹੜੀ ਹੈ ਉਹ ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਅਤੇ ਨਾਈਟ 'ਚ ਇ ਦੋ ਟਾਈਮ ਲਿਖੀ ਹੋਈ ਹੈ ਸਰ ਸਵੇਰੇ ਸ਼ਾਮ ਦੀ

ਠੀਕ ਹੈ ਘੰਟਾ ਘੰਟਾ ਪਹਿਲਾਂ ਲੈਣੀ ਆ ਸਰ ਖਾਣਾ ਖਾਣ ਤੋਂ ਪਹਿਲਾਂ ਠੀਕ ਹੈ ਸਰ ਠੀਕ ਠੀਕ ਬਹੁਤ ਬਹੁਤ ਸ਼ੁਕਰੀਆ ਸਰ ਓਕੇ ਓਕੇ